ਮੇਰਾ ਮਨਪਸੰਦ ਰਸਤਾ ਸਾਡੇ ਕੋਲਜ ਮੇਰੇ ਘਰ ਤੋਂ ਥੋੜ੍ਹੀ ਹੀ ਦੂਰ ਇੱਕ ਗਰਾਉਂਡ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਐਸਟੈਬਲਿਸ਼ ਕੀਤੀ ਹੋਈ ਹੈ ਮਾਲੀਆਂ ਦੁਆਰਾ ਜਿੱਥੇ ਕਿ ਦੋ ਮਾਲੀ ਹਮੇਸ਼ਾ ਹੀ ਰਹਿੰਦੇ ਹਨ ਸਮੇਂ ਸਮੇਂ 'ਤੇ ਘਾਹ ਦੀ ਕਟਾਈ ਕਰਦੇ ਹਨ ਅਤੇ ਪਾਣੀ ਦਿੰਦੇ ਹਨ ਜਦ ਵੀ ਮੈਂ ਘਰ ਤੋਂ ਨਿਕਲਦਾ ਹਾਂ ਤਾਂ ਮਨ ਨੂੰ ਜਾ ਕੇ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਜੋ ਕਿ ਕੋਲਜ ਦੀ ਗਰਾਉਂਡ ਹੈ ਹਮੇਸ਼ਾ ਹੀ ਆਲੇ ਦੁਆਲੇ ਦੇ ਜਿਹੜੇ ਚਾਰ ਆਲੇ ਦੁਆਲੇ ਗਰਾਉਂਡ ਦੇ ਗਲਿਆਰੇ ਦੇ ਦਰਖਤ ਲੱਗੇ ਹਨ ਜਿਨ੍ਹਾਂ ਤੋਂ ਇੱਕ ਆਕਸੀਜਨ ਮਿਲਦੀ ਹੈ ਅਤੇ ਚੰਗੀਆਂ ਵਾਈਬਸ ਮਿਲਦੀਆਂ ਹਨ ਜੋ ਤੁਹਾਡੇ ਜ਼ਿੰਦਗੀ ਵਿੱਚ ਕੰਮ ਆਉਂਦੀਆਂ ਹਨ ਨਾ ਹੀ ਉੱਥੇ ਸ਼ੋਰ ਸ਼ਰਾਬਾ ਹੈ ਨਾ ਹੀ ਕਿਸੇ ਕਿਸਮ ਦੀ ਕੋਈ ਦਿੱਕਤ ਹੈ ਨਾ ਚੱਲਣ 'ਚ ਨਾ ਫਿਰਨ 'ਚ ਹਰੇਕ ਹਰੇਕ ਬੰਦਾ ਆਪੋ ਆਪਣੇ ਟਰੈਕ 'ਤੇ ਜਾ ਰਿਹਾ ਜੋ ਕਿ ਬਹੁਤ ਹੀ ਵਧੀਆ ਹੈ ਜੋ ਕਿ ਜ਼ਿੰਦਗੀ ਨੂੰ ਆਪਣੇ ਆਪ ਨੂੰ ਜੇ ਆਪਾਂ ਕਿਸੇ ਬਜ਼ਾਰ ਦੇ ਵਿੱਚ ਜਾਵਾਂਗੇ ਜਾਂ ਆਪਾਂ ਕਿਸੇ ਸੜਕ 'ਤੇ ਜਾਵਾਂਗੇ ਆਪਾਂ ਨੂੰ ਦਿੱਕਤ ਹੀ ਦਿੱਕਤ ਹੋਵੇਗੀ ਇੱਕ ਗਰਾਊਂਡ ਅਜਿਹੀ ਚੀਜ਼ ਹੈ ਜਿੱਥੇ ਕੋਈ ਵੀ ਫਹੀਕਲ ਜਾਂ ਕੋਈ ਸਾਈਕਲ ਜਾਂ ਕੋਈ ਸਕੂਟਰ ਮੋਟਰਸਾਈਕਲ ਨਹੀਂ ਆਵੇਗਾ ਸਿਰਫ ਪੈਦਲ ਤੁਰਨ ਦਾ ਹੀ ਰਸਤਾ ਹੈ ਅਤੇ ਪੈਦਲ ਤੁਰ ਨਾਲ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਮੈਂ ਇਹ ਕਹਾਂਗਾ ਵੀ ਹਰੇਕ ਬੰਦੇ ਨੂੰ ਆਪਣੇ ਘਰ ਦੇ ਜਾਂ ਦੂਰ ਕਿਸੇ ਵੀ ਗਰਾਊਂਡ ਦੇ ਵਿੱਚ ਜਾ ਕੇ ਦੌੜਨਾ ਜਾਂ ਪ੍ਰੈਕਟਿਸ ਜਾਂ ਚੱਲਣਾ ਚਾਹੀਦਾ ਹੈ